ਪੰਜਾਬ ਦਾ ਕਲਾ ਸ਼ੇਤਰ ਵਿੱਚ ਬਹੁਤ ਵੱਡਾ ਯੋਗਦਾਨ ਏ ਆਪਾਂ ਦੇਖਦੇ ਹੈ ਪੰਜਾਬ ਦੇ ਵਿੱਚ ਪੰਜਾਬੀ ਵਿਰਸੇ ਨੂੰ ਬੜਾ ਸੰਭਾਲ ਕੇ ਰੱਖਿਆ ਹੋਇਆ ਨੇ ਕਈ ਘਰਾਂ ਦੇ ਵਿੱਚ ਹਜੇ ਵੀ ਪੰਜਾਬ ਦੇ ਕਈ ਘਰਾਂ ਦੇ ਵਿੱਚ ਹਜੇ ਵੀ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਨੇ ਕਈ ਔਰਤਾਂ ਆਪਣੇ ਘਰਾਂ ਦੇ ਵਿੱਚ ਦਰੀਆਂ ਬੁਣਦੀਆਂ ਨੇ ਪੱਖੀਆਂ ਬੁਣਦੀਆਂ ਨੇ ਅਤੇ ਪੰਜਾਬੀ ਕਈ ਘਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਪੁਰਾਣੇ ਰੀਤੀ ਰਿਵਾਜ ਵੀ ਅਪਣਾਏ ਜਾਂਦੇ ਨੇ ਹੋਰ ਆਪਾਂ ਦੇਖਦੇ ਹਾਂ ਇੱਥੇ ਵੱਡੇ ਵੱਡੇ ਮੇਲੇ ਵੀ ਲਾਏ ਜਾਂਦੇ ਨੇ ਵੱਡੇ ਵੱਡੇ ਮੇਲਿਆਂ ਦੇ ਵਿੱਚ ਆਪਾਂ ਨੂੰ ਕਈ ਤਰ੍ਹਾਂ ਦੇ ਰੋਜ਼ਗਾਰ ਮਿਲਦੇ ਨੇ ਜਿਵੇਂ ਕਿ ਕੋਈ ਵੀ ਆਪਣੇ ਕਾਰੋਬਾਰ ਨੂੰ ਚਲਾਉਣ ਲਈ ਇੱਥੇ ਮੇਲਿਆਂ ਦੇ ਵਿੱਚ ਆ ਕੇ ਆਪਦੇ ਸਮਾਨ ਨੂੰ ਦਿਖਾਉਂਦਾ ਹੈ ਤਾਂ ਉਸਦੀ ਕਿੱਦਾਂ ਵਰਤੋਂ ਕੀਤੀ ਜਾਂਦੀ ਹੈ ਉਸ ਬਾਰੇ ਆਪਾਂ ਨੂੰ ਜਾਣਕਾਰੀ ਦਿੰਦੇ ਨੇ ਕਈ ਵਾਰ ਮੇਲਿਆਂ ਦੇ ਵਿੱਚ ਲੋਕੀ ਆਪਣੇ ਸਮਾਨ ਨੂੰ ਬਣਾ ਕੇ ਇੱਥੇ ਸੇਲ ਵੀ ਕਰਦੇ ਨੇ ਅਤੇ ਹੋਰ ਦੇਖਣ ਲਈ ਕਈ ਤਰ੍ਹਾਂ ਦੇ ਸੈਰ ਸਪਾਟੇ ਦੀਆਂ ਜਗ੍ਹਾ ਵੀ ਬਣਾਈਆਂ ਗਈਆਂ ਨੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਮੌਲਾਂ ਦੇ ਵਿੱਚ ਘੁੰਮਣ ਲਈ ਬੱਚਿਆਂ ਦੇ ਖੇਡਾਂ ਖੇਡਣ ਲਈ ਅਤੇ ਬਜ਼ੁਰਗਾਂ ਦੇ ਆਰਾਮ ਲਈ ਮਸ਼ੀਨਾਂ ਲਾਈਆਂ ਗਈਆਂ ਨੇ ਜਿੱਥੋਂ ਆਪਾਂ ਦੇਖਦੇ ਹਾਂ ਕਿ ਚੰਡੀਗੜ੍ਹ ਵੱਡੇ ਏਡੇ ਸ਼ਹਿਰ ਦੇ ਵਿੱਚ ਵੱਡੇ ਵੱਡੇ ਮੌਲਾਂ ਦੇ ਵਿੱਚ ਬੱਚਿਆਂ ਦੇ ਖੇਡਣ ਲਈ ਬਹੁਤ ਕੁਛ ਬਣਾਇਆ ਗਿਆ ਹੈ ਲੁਧਿਆਣੇ ਦੇ ਵਿੱਚ ਆਪਾਂ ਦੇਖਦੇ ਹਾਂ ਰੋਜ਼ਗਾਰ ਦੇ ਲਈ ਲੋਕਾਂ ਨੇ ਕਈ ਫੈਕਟਰੀਆਂ ਸ਼ੁਰੂ ਕਰ ਰੱਖੀਆਂ ਨੇ ਜਿਸ ਦੇ ਵਿੱਚ ਸਿਲਾਈ ਮਸ਼ੀਨਾਂ ਹੱਥੀਂ ਕੰਮ ਕਰਨ ਲਈ ਹੋਰ ਖਰਾਦ ਬਣਾਉਣ ਲਈ ਕਈ ਤਰ੍ਹਾਂ ਦੀਆਂ ਫੈਕਟਰੀਆਂ ਲਾਈਆਂ ਹੋਈਆਂ ਨੇ ਇਸ ਦੇ ਨਾਲ ਆਪਣੇ ਆਪਣੇ ਦੇਸ਼ ਦੀ ਤਰੱਕੀ ਦੇ ਵਿੱਚ ਸੈਰ ਸਪਾਟੇ ਲਈ ਵੀ ਕਈ ਮੇਲੇ ਲਾਏ ਜਾਂਦੇ ਨੇ ਅਤੇ ਆਪਾਂ ਇਹਨਾਂ ਮੇਲਿਆਂ ਦੇ ਵਿੱਚ ਆਪਣੀਆਂ ਮਸ਼ੀਨਾਂ ਦਾ ਪ੍ਰਦਰਸ਼ਨ ਕਰਦੇ ਹਾਂ ਅਤੇ ਲੋਕੀ ਇਹਨਾਂ ਨੂੰ ਦੂਰੋਂ ਦੂਰੋਂ ਚੱਲ ਕੇ ਦੇਖਣ ਲਈ ਆਉਂਦੇ ਨੇ ਜਿਵੇਂ ਕਿ ਆਪਾਂ ਵੱਡੇ ਵੱਡੇ ਸ਼ਹਿਰ ਦੇ ਵਿੱਚੋ ਜਿਵੇਂ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਆਪਾਂ ਘੁੰਮਣ ਲਈ ਦੂਰੋਂ ਦੂਰੋਂ ਲੋਕੀ ਇੱਥੇ ਆਉਂਦੇ ਨੇ ਤਾਂ ਉਹਨਾਂ ਲਈ ਵੀ ਬਹੁਤ ਰੋਜ਼ਗਾਰ ਦੇ ਸਾਧਨ ਉ ਉਪਲਬਧ ਕਰਾਏ ਜਾਂਦੇ ਨੇ ਜਿਵੇਂ ਕਿ ਕੋਈ ਵੀ ਵਿਅਕਤੀ ਇੱਥੇ ਘੁੰਮਣ ਲਈ ਆਉਂਦਾ ਨੇ ਤਾਂ ਉਹ ਪਹਿਲਾਂ ਟਿਕਟ ਕਰਵਾਉਂਦਾ ਨੇ